ਸਾਡੇ ਪਿੰਡ ਵਿੱਚ ਖੁੱਲੇ ਪਖਾਨਾ ਜਾਣਾ ਆਮ ਗੱਲ ਬਿਲਕੁਲ ਵੀ ਨਹੀਂ ਹੈ ਹਾਂ ਪਰ ਨਾਲ ਦੇ ਪਿੰਡਾਂ ਦੇ ਵਿੱਚ ਖੁੱਲੇ ਪਖਾਨੇ ਜਾਣਾ ਇਕ ਆਮ ਗੱਲ ਹੈ ਇਹ ਇੱਕ ਸਾਡੇ ਲਈ ਬਹੁਤ ਹੀ ਵੱਡੀ ਭਾਰੀ ਸਮੱਸਿਆ ਹੈ ਇਸ ਦੇ ਬਹੁਤ ਸਾਰੇ ਨੁਕਸਾਨ ਹਨ ਇਸ ਦੇ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਬਹੁਤ ਸਾਰੇ ਕ੍ਰਾਈਮ ਵੱਧਦੇ ਹਨ ਕੁੜੀਆਂ ਦੇ ਲਈ ਤੜਕੇ ਹਨੇਰੇ ਵਿੱਚ ਸ਼ੌਚਾਲਿਆ ਜਾਣਾ ਬਹੁਤ ਹੀ ਖਤਰਨਾਕ ਸਿੱਧ ਹੋ ਸਕਦਾ ਇਸ ਦੇ ਨਾਲ ਬਹੁਤ ਜਿਆਦਾ ਕ੍ਰਾਈਮ ਵੱਧ ਸਕਦੇ ਹਨ ਅਤੇ ਇਸ ਦੇ ਲਈ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ ਇਸ ਲਈ ਖੁੱਲੇ ਦੇ ਵਿੱਚ ਪਖਾਨਾ ਜਾਣਾ ਬਹੁਤ ਹੀ ਖਤਰਨਾਕ ਹੈ ਇਸ ਦੇ ਨਾਲ ਇਸ ਦੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਨਾਲ ਨੁਕਸਾਨ ਵੀ ਬਹੁਤ ਸਿੱਧ ਹੋਏ ਹਨ ਇਸ ਲਈ ਪਿੰਡਾਂ ਦੇ ਵਿੱਚ ਇਸ ਹਰ ਥਾਂ 'ਤੇ ਸ਼ੌਚਾਲਿਆ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਖਾਸ ਕਰਕੇ ਲੜਕੀਆਂ ਲਈ ਲੜਕੀਆਂ ਲਈ ਪਿੰਡ 'ਚ ਖੁੱਲੇ 'ਚ ਜਾਣਾ ਬਹੁਤ ਹੀ ਬਿਲਕੁਲ ਹੀ ਵਧੀਆ ਗੱਲ ਨਹੀਂ ਹੈ ਅਤੇ ਇਸ ਦੇ ਸਖਤ ਖਿਲਾਫ ਹੋਣਾ ਚਾਹੀਦਾ ਹੈ ਇਸ ਲਈ ਪਿੰਡ 'ਚ ਖੁੱਲੇ 'ਚ ਜਾਣਾ ਬਿਲਕੁਲ ਵੀ ਸਹੀ ਨਹੀਂ ਹੈ ਇਸ ਦੇ ਨਾਲ ਆਸ ਪਾਸ ਦੇ ਜ ਜਾਨਵਰਾਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੈ ਉਹਨਾਂ ਦੇ ਉਹਨਾਂ ਨੂੰ ਵੀ ਬਹੁਤ ਸਾਰੇ ਨੁਕਸਾਨ ਹਨ ਇਸ ਦੇ ਇਸ ਲਈ ਸਾਨੂੰ ਅਖੀਰ 'ਚ ਇਹੀ ਕਹਿਣਾ ਵੀ ਇਸ ਦੇ ਸਾਨੂੰ ਬਹੁਤ ਸਾਰੇ ਨੁਕਸਾਨ ਹੈ ਇਸ ਲਈ ਸਾਨੂੰ ਪਿੰਡ ਵਿੱਚ ਖੁੱਲੇ ਜਾਣਾ ਬਿਲਕੁਲ ਨਹੀਂ ਅਤੇ ਸਾਡੇ ਪਿੰਡ ਵਿੱਚ ਇਹੋ ਜਿਹੀ ਹਰ ਥਾਂ 'ਤੇ ਸ਼ੌਚਾਲਿਆ ਹੈ